ਮੈਂ ਗਾਉਣ ਦਾ ਪ੍ਰਦਰਸ਼ਨ ਕਰਦੇ ਸਮੇਂ ਇਹ ਧਿਆਨ ਰੱਖਦਾ ਹਾਂ ਕਿ ਮੇਰਾ ਧਿਆਨ ਹਮੇਸ਼ਾ ਹੀ ਜੋ ਮੈਨੂੰ ਸੁਣ ਰਿਹਾ ਹੈ ਉਸ ਵੱਲ ਹੋਵੇ ਨਹੀਂ ਤਾਂ ਜੇ ਮੈਂ ਘਰ 'ਚ ਅਭਿਆਸ ਕਰਦਾ ਹਾਂ ਤਾਂ ਮੈਂ ਸ਼ੀਸ਼ੇ ਦੇ ਵੱਲ ਦੇਖ ਕੇ ਗਾਉਂਦਾ ਹਾਂ ਅਤੇ ਮੈਂ ਇਹ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਜਦੋਂ ਵੀ ਗਾਵਾਂ ਮੇਰੇ ਚਿਹਰੇ 'ਤੇ ਇੱਕ ਸੁੰਦਰ ਜਿਹੀ ਮੁਸਕਾਨ ਹੋਵੇ ਅਤੇ ਕੋਈ ਚਿੰਤਾ ਦੀ ਲਕੀਰ ਨਾ ਹੋਵੇ

ਅਭਿਆਸ ਤੋਂ ਇਲਾਵਾ ਬਿਹਤਰ ਚੀਜ਼ਾਂ ਖਾਂਦਾ ਹਾਂ ਅਤੇ ਗਰਮ ਰੋਜ਼ ਹੀ ਸਵੇਰੇ ਗਰਮ ਪਾਣੀ ਪੀਂਦਾ ਹਾਂ ਅਤੇ ਬਾਹਰ ਦੀਆਂ ਚੀਜ਼ਾਂ ਜਿਵੇਂ ਸਪ੍ਰਿੰਗ ਰੋਲ ਮੋਮੋਜ ਆਦਿ ਇਹ ਬਿਲਕੁਲ ਨਹੀਂ ਖਾਂਦਾ ਜੇਕਰ ਖਾਂਦਾ ਵੀ ਹਾਂ ਕਦੇ ਤਾਂ ਬਹੁਤ ਹੀ ਥੋੜ੍ਹਾ ਖਾਂਦਾ ਹਾਂ ਕਿਉਂਕਿ ਹਮੇਸ਼ਾ ਹੀ ਮੈਂ ਘਰ ਦੇ ਬਣੇ ਖਾਣੇ ਨੂੰ ਹੀ ਤਵੱਜੋ ਦਿੰਦਾ ਹਾਂ ਕਿਉਂਕਿ ਇਹ ਸ਼ੁੱਧ ਹੁੰਦਾ ਹੈ ਅਤੇ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਸਾਡੇ ਬੁਕਣ ਨੂੰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਹੈ ਅਤੇ ਇੱਕ ਚੰਗਾ ਪ੍ਰਦਰਸ਼ਨ ਦਿੰਦਾ ਹੈ